ਅੱਜ ਕੱਲ੍ਹ ਤੋਹਫ਼ਿਆਂ ਨੂੰ ਦੇਣ ਦਾ ਪ੍ਰਚਲਨ ਕਾਫ਼ੀ ਵੱਧ ਗਿਆ ਹੈ ਅਤੇ ਇਸ ਸਮੇਂ ਕਈ ਤਰ੍ਹਾਂ ਦੇ ਵੱਖਰੇ ਵੱਖਰੇ ਤਰ੍ਹਾਂ ਦੇ ਤੋਹਫ਼ੇ ਦਿੱਤੇ ਜਾਂਦੇ ਹਨ ਜਿਹਨਾਂ ਵਿੱਚ ਕਾਰਡ ਹੋ ਗਿਆ ਪੇਂਟਿੰਗ ਹੋ ਗਈ ਪਰ ਇੱਥੇ ਦੱਸ ਦੇਣਾ ਜ਼ਰੂਰੀ ਹੈ ਕਿ ਮੈਂ ਵੀ ਆਪਣੇ ਜੀਵਨ ਵਿੱਚ ਕਈ ਲੋਕਾਂ ਨੂੰ ਤੋਹਫ਼ੇ ਦਿੱਤੇ ਹਨ ਪਰ ਮੈਂ ਜ਼ਿਆਦਾ ਬਜ਼ਾਰੀ ਤੋਹਫ਼ਿਆਂ ਨਾਲ਼ੋਂ ਹੱਥ ਨਾਲ਼ ਬਣੇ ਹੋਏ ਤੋਹਫ਼ਿਆਂ ਨੂੰ ਜ਼ਿਆਦਾ ਮਿਹਨਤ ਦਿੰਦਾ ਹਾਂ ਅਤੇ ਮੈਂ ਇਸ ਇਸ ਤਰ੍ਹਾਂ ਕਈ ਆਪਣੇ ਦੋਸਤਾਂ ਨੂੰ ਨਵੇਂ ਸਾਲ 'ਤੇ ਦਿਵਾਲੀ 'ਤੇ ਅਤੇ ਹੋਰ ਕਈ ਮੌਕਿਆਂ 'ਤੇ ਹੱਥ ਨਾਲ਼ ਬਣੇ ਹੋਏ ਤੋਹਫ਼ੇ ਦੇਣਾ ਪਸੰਦ ਕਰਦਾ ਹਾਂ ਅਤੇ ਕਈ ਤਰ੍ਹਾਂ ਦੀਆਂ ਪੇਂਟਿੰਗਸ ਵੀ ਮੈਂ ਬਣਾ ਲੈਂਦਾ ਹਾਂ ਜੋ ਕਿ ਮੈਂ ਆਪਣੇ ਦੋਸਤਾਂ ਵਿੱਚ ਦੇਣਾ ਦੇ ਦਿੰਦਾ ਹਾਂ ਮੇਰੇ ਅਨੁਸਾਰ ਹੱਥ ਨਾਲ਼ ਬਣੇ ਹੋਏ ਤੋਹਫ਼ਿਆਂ ਵਿੱਚ ਭਾਵਨਾਤਮਕ ਮੁੱਲ ਛੁਪਿਆ ਹੁੰਦਾ ਹੈ ਅਤੇ ਇਹ ਇੱਕ ਤਰ੍ਹਾਂ ਦੀ ਭਾਵਨਾ ਹੁੰਦੀ ਹੈ ਕਿ ਤੁਸੀਂ ਮਨੁੱਖ ਨੂੰ ਕਿੰਨਾ ਪਿਆਰ ਕਰਦੇ ਹੋ ਜੋ ਕਿ ਇੱਕ ਬਜ਼ਾਰੀ ਅਤੇ ਹੱਥ ਨਾਲ਼ ਬਣੇ ਤੋਹਫ਼ੇ ਜਿਹੜੇ ਆ ਜ਼ਿਆਦਾ ਅਹਿਮੀਅਤ ਰੱਖਦੇ ਹਨ